ਮੈਂ ਨੇੜੇਲੇ ਕਸਬਿਆਂ ਜਾਂ ਪਿੰਡਾਂ ਵਿੱਚ ਇੱਕ ਦੋ ਵਾਰ ਹੀ ਦੌਰਾ ਕਰਦੀ ਹਾਂ ਕਿਉਂਕਿ ਮੇਰੇ ਕੋਲ ਇੰਨਾਂ ਸਮੇਂ ਨਹੀਂ ਬਚਦਾ ਕਿ ਮੈਂ ਪਿੰਡਾਂ ਵਿੱਚ ਜ਼ਿਆਦਾ ਵਾਰ ਦੌਰਾ ਕਰ ਸਕਾਂ ਪਰ ਕਦੇ ਕਦੇ ਜਦੋਂ ਅਸੀਂ ਮੇਰੇ ਨਾਨਕੇ ਪਿੰਡ ਜਾਂਦੇ ਹਾਂ ਤਾਂ ਉੱਥੇ ਜਾ ਕੇ ਮੈਨੂੰ ਸ਼ਹਿਰ ਅਤੇ ਪਿੰਡ ਦੇ ਵਿੱਚ ਘਰ ਆਉਣ ਵਾਲੀ ਚੀਜ਼ਾਂ ਦਾ ਪਤਾ ਚਲਦਾ ਹੈ ਕਿ ਇੱਥੋਂ ਨਾਲੋਂ ਉੱਥੋਂ ਕੀ ਫਰਕ ਹੈ ਉੱਥੋਂ ਦੇ ਬੱਚਿਆਂ ਦਾ ਰਹਿਣ ਸਹਿਣ ਅਤੇ ਸ਼ਹਿਰ ਦੇ ਬੱਚਿਆਂ ਦਾ ਰਹਿਣ ਸਹਿਣ ਬਹੁਤ ਅਲੱਗ ਹੁੰਦਾ ਹੈ ਪਿੰਡਾਂ ਦੀ ਸਾਫ ਹਵਾ ਅਤੇ ਸ਼ਹਿਰਾਂ ਦੇ ਪ੍ਰਦੂਸ਼ਣ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਪਿੰਡ ਵਿੱਚ ਰਹਿਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਇਹ ਇੰਨੀ ਸੌਖੀ ਗੱਲ ਵੀ ਨਹੀਂ ਹੈ ਸ਼ਹਿਰਾਂ ਵਿੱਚ ਰਹਿਣ ਤੋਂ ਬਾਅਦ ਪਿੰਡਾਂ ਵਿੱਚ ਰਹਿਣਾ ਥੋੜ੍ਹਾ ਔਖਾ ਲੱਗਦਾ ਹੈ ਪਰ ਪਿੰਡਾਂ ਦੀ ਪਿੰਡਾਂ ਦੇ ਅੱਜ ਕੱਲ੍ਹ ਨਕਸ਼ਾ ਦੇਖ ਕੇ ਲੱਗਦਾ ਹੀ ਨਹੀਂ ਕਿ ਭਾਰਤ ਵਿੱਚ ਹੋਰ ਪਿੰਡ ਬਚਣਗੇ